ਜੇਕਰ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਿ ਸਾਨੂੰ ਚੌਵੀ ਘੰਟੇ ਉਪਲਬਧ ਹੋਣੀ ਚਾਹੀਦੀ ਹੈ ਕਿਉਂਕਿ ਬਿਜਲੀ ਦੇ ਨਾਲ ਸਾਰੇ ਸਾਰੇ ਇੰਸਟਰੂਮੈਂਟਸ ਨੇ ਜਿਹੜੇ ਸਾਡੇ ਪੱਖੇ ਨੇ ਬਾਕੀ ਜੇ ਗਰਮੀ ਦੇ ਮੌਸਮ ਦੀ ਗੱਲ ਕਰੀਏ ਤਾਂ ਉਹਦੇ 'ਚ ਪੱਖੇ ਕੂਲਰ ਏ ਸੀ ਤੋਂ ਲੈ ਕੇ ਸਾਰਾ ਕੁਛ ਚੱਲਦਾ ਹੈ ਜੇ ਅਸੀਂ ਗਰਮੀਆਂ ਦੀ ਗੱਲ ਕਰੀਏ ਤਾਂ ਜਿਵੇਂ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਗਰਮੀਆਂ ਦੇ ਵਿੱਚ ਬੜਾ ਹੀ ਮੁਸ਼ਕਿਲ ਬੇਚੈਨ ਹੁੰਦੇ ਜੇ ਅੱਧੇ ਪੌਣੇ ਘੰਟੇ ਦਾ ਵੀ ਕੱਟ ਲੱਗਦਾ ਹੈ ਤਾਂ ਤਰਾਹੀ ਤਰਾਹੀ ਮੱਚ ਜਾਂਦੀ ਹੈ ਜੇ ਇਹੀ ਆਪਾਂ ਸਰਦੀਆਂ ਦੀ ਗੱਲ ਕਰੀਏ ਸਰਦੀਆਂ ਦੇ ਵਿੱਚ ਸਾਨੂੰ ਪੱਖੇ ਕੂਲਰ ਏ ਸੀ ਤੋਂ ਬਗੈਰ ਵੀ ਸਾਡਾ ਕੰਮ ਚੱਲ ਜਾਂਦਾ ਹੈ ਅਤੇ ਇਸ ਲਈ ਸਾਨੂੰ ਸਰਦੀਆਂ ਦੇ ਵਿੱਚ ਇਹ ਘੱਟ ਪ੍ਰਭਾਵਿਤ ਕਰਦੀ ਹੈ ਪਰ ਜੇ ਇਹ ਗਰਮੀਆਂ ਦੀ ਹੈ ਗਰਮੀ ਗੱਲ ਕਰਦੇ ਹਾਂ ਤਾਂ ਗਰਮੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਸਾਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਬਿਜਲੀ ਅੱਜ ਕੱਲ੍ਹ ਉਪਲਬਧ ਹੋਣੀ ਬਹੁਤ ਹੀ ਜ਼ਰੂਰੀ ਹੈ ਜੇ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਅਸੀਂ ਕੰਪਲੇਟਾਂ ਵੀ ਕਰਦੇ ਹਾਂ ਬਟ ਇਹ ਸਾਨੂੰ ਸਰਕਾਰਾਂ ਨੂੰ ਚਾਹੀਦਾ ਹੈ ਵੀ ਇਹ ਬਿਜਲੀਆਂ ਸਾਨੂੰ ਚੌਵੀ ਘੰਟੇ ਉਪਲਬਧ ਹੋਣੀਆਂ ਚਾਹੀਦੀਆਂ ਜਿਵੇਂ ਹੁਣ ਪੰਜਾਬ ਸਰਕਾਰ ਨੇ ਵੀ ਅੱਜ ਕੱਲ੍ਹ ਸਾਰੇ ਬਿਜਲੀ ਦੇ ਜਿਹੜੇ ਯੂਨਿਟ ਨੇ ਉਹ ਮੁਆਫ ਕੀਤੇ ਹੋਏ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਵੀ ਲੋਕ ਇਹਨਾਂ ਨੂੰ ਵੱਧ ਬਿਜਲੀ ਇਹਨਾਂ ਦੀ ਵਰਤੋਂ ਕਰਨਗੇ ਅਤੇ ਛੇ ਸੌ ਯੂਨਿਟ ਤੱਕ ਆਪਣੇ ਪੂਰੇ ਯੂਨਿਟ ਚਲਾ ਕੇ ਚਾਹੇ ਉਹਨਾਂ ਨੂੰ ਚਾਹੀਦੀ ਹੈ ਚਾਹੇ ਨਹੀਂ ਚਾਹੀਦੀ ਇਹ ਵਰਤ ਕੇ ਇਹ ਇਹ ਸਾਰੇ ਵਰਤ ਕੇ ਉਹਨਾਂ ਨੂੰ ਮਿਸਯੂਜ਼ ਵੀ ਕਰ ਸਕਦੇ ਹਨ ਅਤੇ ਮੇਰਾ ਮੰਨਣਾ ਹੈ ਵੀ ਇਹ ਫਰੀ ਵਾਲੀ ਬਿਜਲੀ ਜਿਹੜੀ ਹੈ ਉਹ ਨਾ ਦੇ ਕੇ ਚੌਵੀ ਘੰਟੇ ਉਪਲਬਧ ਦੇ ਕੇ ਚਾਹੇ ਰੇਟ ਘੱਟ ਕਰ ਦੇਣ ਅਤੇ ਇਹ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਧੰਨਵਾਦ ਜੀ